ਮੈਂ ਹਿੰਦੂ ਧਰਮ ਨੂੰ ਮੰਨਦੀ ਹਾਂ ਹਿੰਦੂ ਧਰਮ ਦੇ ਵਿੱਚ ਲੋਕ ਮਾਸ ਖਾਣਾ ਵਾਲੇ ਨੂੰ ਚੰਗਾ ਨਹੀਂ ਸਮਝਦੇ ਹਨ ਹਿੰਦੂ ਧਰਮ ਦੇ ਵਿੱਚ ਜੈਨ ਧਰਮ ਕ੍ਰਿਸ਼ਨ ਧੰ ਜਿਹਨੂੰ ਜਿਹੜੇ ਲੋਕ ਮੰਨਦੇ ਹਨ ਉਹ ਲੋਕ ਅਤੇ ਪਿਆਜ ਲਸਨ ਖਾਂਦੇ ਵੀ ਨਹੀਂ ਹਨ ਹਿੰਦੂ ਧਰਮ ਦੇ ਵਿੱਚ ਜਿਹੜੇ ਕ੍ਰਿਸ਼ਨ ਜੀ ਨੂੰ ਮੰਨਦੇ ਹਨ ਉਸ ਵਿੱਚ ਬੜੇ ਹੀ ਵਿਵਾਦ ਹਨ ਜਿਹੜੇ ਲੋਕ ਪਿਆਜ ਲਸਣ ਆਦਿ ਖਾਂਦੇ ਹਨ ਅਤੇ ਕਈ ਵਾਰੀ ਜਿਹੜੇ ਲੋਕ ਆਪਣੇ ਮਹਾਰਾਜ ਜੀ ਨੂੰ ਮੰਨਦੇ ਹਨ ਅਤੇ ਉਹ ਵੀ ਲੋਕ ਕਹਿੰਦੇ ਹਨ ਕਿ ਜਿਹੜੇ ਸਾਡੇ ਮਹਾਰਾਜ ਜੀ ਹੈ ਉਹ ਕਹਿੰਦੇ ਹਨ ਕਿ ਕਿਸੇ ਦੇ ਘਰ ਆਉਣਾ ਨਹੀਂ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਕਿਸੇ ਦੀ ਜਦੋਂ ਖੁਸ਼ੀ ਹੁੰਦੀ ਉਸ ਟਾਈਮ ਦੇ ਉੱਤੇ ਉਹਨਾਂ ਦੇ ਘਰ ਦਾ ਖਾ ਰੋਟੀ ਵਗੈਰਾ ਨਹੀਂ ਖਾਂਦੇ ਹਨ ਹਿੰਦੂ ਧਰਮ ਦੇ ਵਿੱਚ ਕਈ ਐਸੇ ਵੀ ਗੁਰੂ ਹਨ ਜਿਹੜੇ ਕਹਿੰਦੇ ਹਨ ਕਿ ਜਿਹੜੇ ਪਿਆਜ ਲਸਣ ਖਾਂਦੇ ਆ ਉਹਨਾਂ ਨੂੰ ਅਪਣਾਉਂਦੇ ਹੀ ਨਹੀਂ ਹਨ ਹਿੰਦੂ ਧਰਮ ਦੇ ਵਿੱਚ ਜਿਹੜੇ ਕ੍ਰਿਸ਼ਨ ਜੀ ਨੂੰ ਬਹੁਤ ਜ਼ਿਆਦਾ ਜਿਹੜੇ ਲੋਕ ਮੰਨਦੇ ਹਨ ਅਤੇ ਉਹ ਲੋਕ ਕਹਿੰਦੇ ਹਨ ਨੋ ਮਾਸਾਹਾਰੀ ਲੋਕਾਂ ਨੂੰ ਅਤੇ ਬਿਲਕੁਲ ਵੀ ਨਹੀਂ ਆਪਣੇ ਘਰ ਆਉਣ ਦਿੰਦੇ ਹਨ ਅਤੇ ਉਹ ਕਹਿੰਦੇ ਹਨ ਬਿਲਕੁਲ ਸ਼ੁੱਧ ਹੋ ਗਿਆ ਜੇ ਅਸੀਂ ਕਿਸੇ ਦੇ ਘਰ ਵੀ ਜਾਣਾ ਹੈ ਅਤੇ ਬਿਲਕੁਲ ਸ਼ੁੱਧ ਹੋ ਕੇ ਮਨ ਜਾਣਾ ਹੁੰਦਾ ਹੈ ਇਸ ਵਿੱਚ ਬਹੁਤ ਸਾਰੇ ਵਿਵਾਦਪੂਰਨ ਮੁੱਦੇ ਇਹ ਵੀ ਹੋ ਜਾਂਦੇ ਹਨ ਕਿ ਕਈ ਵਾਰੀ ਜਿਹੜੇ ਹਿੰਦੂ ਧਰਮ 'ਚ ਕ੍ਰਿਸ਼ਨ ਲੋਕ ਜੀ ਨੂੰ ਮੰਨਦੇ ਹਨ ਉਹ ਲੋਕ ਦੂਸਰੇ ਦੇ ਜਿਹੜੇ ਆਪਣੇ ਹੀ ਗੁਰੂ ਨੂੰ ਜਿਹੜੇ ਮੰਨਦੇ ਹਨ ਉਹਨੂੰ ਗੁਰੂ ਸਖੀਆਂ ਬਣਾ ਕੇ ਹੀ ਆਪਣੇ ਗੁਰੂ ਨੂੰ ਮੰਨਣ ਵਾਲੇ ਲੋਕ ਉਹਨਾਂ ਦੇ ਗੁਰੂਆਂ ਦੇ ਘਰ ਹੀ ਜਾਂਦੇ ਹਨ ਅਤੇ ਜਿਹੜੇ ਲੋਕ ਪਿਆਜ ਲਸਨ ਆਦਿ ਖਾਂਦੇ ਹਨ ਉਹਨਾਂ ਦੀਆਂ ਰਸੋਈਆਂ ਦੇ ਵਿੱਚ ਵੀ ਰੋਟੀ ਵਗੈਰਾ ਨਹੀਂ ਖਾਣੀ ਪਸੰਦ ਕਰਦੇ ਹਨ ਹਿੰਦੂ ਧਰਮ ਦੇ ਵਿੱਚ ਬਹੁਤ ਸਾਰੇ ਐਸੇ ਵੀ ਹਨ ਗੁਰੂ ਜਿਹੜੇ ਕਹਿੰਦੇ ਹਨ ਕਿ ਸਿਰਫ ਪਿਆਜ ਲਸਨ ਮਾਸਾਹਾਰੀ ਲੋਕਾਂ ਨੂੰ ਤਾਂ ਆਓ ਆਪਣੇ ਹੀ ਵਿੱਚ ਸ਼ਾਮਿਲ ਵੀ ਨਹੀਂ ਕਰਦੇ ਹਨ ਮਾਸ ਖਾਣਾ ਹਿੰਦੂ ਧਰਮ ਵਿੱਚ ਵਰਜਿਤ ਮੰਨਿਆ ਜਾਂਦਾ ਹੈ ਪਰ ਹੁਣ ਇਹੋ ਜਿਹਾ ਸਮਾਂ ਆ ਗਿਆ ਹਨ ਅਤੇ ਕਈ ਲੋਕ ਤਾਂ ਮਾਸ ਵਗੈਰਾ ਖਾ ਲੈਂਦੇ ਹਨ ਜਿੱਦਾਂ ਅੰਡੇ ਵਗੈਰਾ ਖਾ ਲੈਂਦੇ ਹਨ ਉਹ ਲੋਕਾਂ ਨੂੰ ਉਹ ਕਹਿੰਦੇ ਹਨ ਕਿ ਅੱਜ ਕੱਲ੍ਹ ਦੇ ਨਵੇਂ ਸਮ ਸਮੇਂ ਦੇ ਵਿੱਚ ਕਿ ਅੰਡੇ ਜਾਂ ਮਾਸ ਖਾਣਾ ਕੋਈ ਇਹੋ ਜਿਹੀ ਵੱਡੀ ਗੱਲ ਨਹੀਂ ਹਨ ਪਰ ਇਸ ਵਿੱਚ ਹਜੇ ਵੀ ਬਹੁਤ ਸਾਰੇ ਵਿਵਾਦ ਮੰਨੇ ਜਾਂਦੇ ਹਨ ਹਿੰਦੂ ਧਰਮ ਦੇ ਵਿੱਚ ਧਰਮ ਨੂੰ ਵਿੱਚ ਜਿਹੜੇ ਮਾਸ ਖਾਂਦੇ ਹਨ ਜਿਹੜੇ ਉਹਨਾਂ ਦੇ ਕਰਮ ਕਾਂਡ ਹਨ ਕਈ ਧਰਮਾਂ ਦੇ ਵਿੱਚ ਤਾਂ ਲੋਕ ਜਿੱਦਾਂ ਇਸਾਈਆਂ ਨੂੰ ਮੰਨਦੇ ਹਨ ਅਤੇ ਉਹ ਕਿਸੇ ਦੇ ਜਨਮਦਿਨਾਂ ਦੇ ਉੱਤੇ ਟੋਫੀਆਂ ਵਗੈਰਾ ਜਾਂ ਕੋਈ ਗਿਫਟ ਦਿੰਦੇ ਹਨ ਅਤੇ ਉਹ ਵੀ ਨਹੀਂ ਲੈਂਦੇ ਹਨ ਮੇਰੇ ਕੋਲ ਇੱਦਾਂ ਹੀ ਇੱਕ ਬੱਚਾ ਆਉਂਦਾ ਸੀ ਜਿਹੜੇ ਇਸਾਈ ਧਰਮ ਨੂੰ ਮੰਨਦਾ ਸੀ ਦੂਸਰੇ ਬੱਚੇ ਜਦੋਂ ਜਨਮਦਿਨ ਕਰਦੇ ਸਨ ਤਾਂ ਉਹ ਬੱਚਾ ਉਹ ਬੱਚੇ ਬੱਚੇ ਦੇ ਜਨਮ ਦਿਨ ਦੀ ਇੱਕ ਟੋਫੀ ਜਾਂ ਕੁਛ ਹੋਰ ਚੀਜ਼ ਵੀ ਨਹੀਂ ਸੀ ਲੈਂਦਾ ਉਹ ਕਹਿੰਦਾ ਸਾਡੇ ਧਰਮ ਦੇ ਵਿੱਚ ਇਹ ਵਰਜਿਤ ਹੈ